ਮੈਂ ਛੇ ਮਹੀਨੇ ਪਹਿਲਾਂ ਆਪਣਾ ਪਾਸਪੋਰਟ ਅਪਲਾਈ ਕੀਤਾ ਸੀ ਜਿਸ ਦੇ ਵਿੱਚ ਮੈਨੂੰ ਇੱਕ ਐਕਨੋਲੋਜਮੈਂਟ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਮੈਂ ਆਪਣਾ ਪਾਸਪੋਰਟ ਲੈਣਾ ਭੁੱਲ ਗਈ ਕਿਸੇ ਕਾਰਨ ਦੇ ਕਰਕੇ ਮੈਂ ਯਾਦ ਨਹੀਂ ਕਰ ਸਕੀ ਕਿ ਮੈਂ ਪਾਸਪੋਰਟ ਲੈ ਕੇ ਆਉਣਾ ਹੈ ਉਸ ਦੇ ਨਾਲ ਹੀ ਮੈਨੂੰ ਉਸ ਦੀ ਐਕਨੋਲਜਮੈਂਟ ਸਲਿਪ ਜਿਹੜੀ ਸੀ ਉਹ ਵੀ ਖੋ ਚੁੱਕੀ ਹੈ ਇਸ ਕਰਕੇ ਮੈਂ ਹੁਣ ਤੁਹਾਡੇ ਤੋਂ ਆਪਣਾ ਪਾਸਪੋਰਟ ਟਰੈਕ ਕਰਨ ਬਾਰੇ ਤੁਹਾਨੂੰ ਸੂਚਿਤ ਕਰਦੀ ਹਾਂ ਕੀ ਤੁਸੀਂ ਏ ਮੈਨੂੰ ਮੇਰੇ ਪਾਸਪੋਰਟ ਬਾਰੇ ਕੋਈ ਵੀ ਜਾਣਕਾਰੀ ਦੇ ਸਕਦੇ ਹੋ ਜਿਸ ਦੇ ਨਾਲ ਮੇਰੇ ਕੋਲ ਹੁਣ ਸਿਰਫ਼ ਇੱਕ ਪਾਸਪੋਰਟ ਸਲਿਪ ਦੀ ਫੋਟੋਕਾਪੀ ਹੀ ਹੈ ਮੇਰੇ ਮੇਰਾ ਨਾਮ ਸਿਮਰਨਜੀਤ ਕੌਰ ਜਿਸ ਦਾ ਪਾਸਪੋਰਟ ਨੰਬਰ ਬਹੱਤਰ ਬਿਆਸੀ ਚੁਰਾਸੀ ਅਠੱਤਰ ਉਣੱਤੀ ਤੇਹੱਤਰ ਸੀ ਕਿਰਪਾ ਕਰਕੇ ਤੁਸੀਂ ਮੈਨੂੰ ਮੇਰੇ ਪਾਸਪੋਰਟ ਦੀ ਟਰੈਕ ਸਥਿੱਤੀ ਪਤਾ ਕਰਕੇ ਦੱਸੋ ਵੀ ਜੇ ਕੀ ਮੈਂ ਆਪਣਾ ਪਾਸਪੋਰਟ ਜਲਦੀ ਤੋਂ ਜਲਦੀ ਪ੍ਰਾਪਤ ਕਰ ਸਕਦੀ ਹਾਂ